ਹਾਂਜੀ ਬੇਟੇ ਸਰਵਨ ਸਿੰਘ ਬੋਲਦੇ ਹੋ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਘਰ ਸਾਰੇ ਠੀਕ ਆ ਹਾਂਜੀ ਬੇਟੇ ਵਧੀਆ ਹੋਰ ਤੇਰੀ ਮੰਮੀ ਵਰਗੇ ਠੀਕ ਹੈ ਸਾਰੀ ਘਰ ਹਾਂ ਤੇ ਬੇਟੇ ਮੈਂ ਨਾ ਇੱਥੇ ਲੁਧਿਆਣੇ ਤੋਂ ਮੁਕਤਸਰ ਆਉਣਾ ਦਰਬਾਰ ਸਾਹਿਬ ਮੱਥਾ ਟੇਕਣ ਹਾਂਜੀ ਬੇਟੇ ਅਤੇ ਮੈਨੂੰ ਵੀ ਕਾਹਦੇ 'ਤੇ ਆਵਾਂ ਕਿਹੜੀ ਚੀਜ਼ 'ਤੇ ਆਵਾਂ ਜਿਹਦੇ ਨਾਲ ਮੈਂ ਸੌਖਾ ਸੌਖੀ ਆ ਸਕਾਂ ਜਾਂ ਮੈਂ ਮੱਥਾ ਟੇਕਣ ਹਾਂਜੀ

ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਆ ਅਤੇ ਇੱਥੇ ਕੋਈ ਰਹਿਣ ਵਾਸਤੇ ਵਧੀਆ ਕੋਈ ਜਗ੍ਹਾ ਹੈ ਹੋਟਲ ਵਗੈਰਾ ਜਾਂ ਕੋਈ ਗੁਰੂ ਘਰ ਦੇ ਵਿੱਚ ਹੀ ਕੋਈ ਕਮਰਾ ਮਿਲ ਜੂਗਾ ਨਾ

ਠੀਕ ਹੈ ਜੀ ਹਾਂਜੀ ਅਤੇ ਹੋਰ ਹੋਰ ਕਿਹੜੇ ਇੱਧਰ ਇੱਥੇ ਦਰਬਾਰ ਸਾਹਿਬ ਤੋਂ ਇਲਾਵਾ ਵੀ ਆਪਾਂ ਹੋਰ ਵੀ ਸਥਾਨ ਜੇ ਹੋਰ ਕਿਹੜੇ ਕਿਹੜੇ ਆਪਣੇ ਗੁਰਦੁਆਰਾ ਸਾਹਿਬ ਉਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਦੇ ਦਿਆ ਜੇ

ਹਾਂਜੀ ਹਾਂਜੀ ਜਿਵੇਂ ਗੁਰੂ ਘਰ ਆਪਣੇ ਇੱਧਰ ਦਾਤਣਸਰ ਮੰਨ ਲਾ ਟਿੱਬੀ ਸਾਹਿਬ ਰੋਡ ਹਾਂਜੀ ਹੈਲੋ ਹਾਂਜੀ ਠੀਕ ਹੈ ਮੁਕਤਸਰ ਮੁਕਤਸਰ ਸਿੱਧਾ ਅੱਡੇ 'ਚ ਆ ਕੇ ਉਤਰ ਕੇ ਅਤੇ ਵੀ ਮੰਨ ਲਓ ਅਸੀਂ ਆਟੋ ਵਗੈਰਾ ਕਰਾ ਲਈਏ ਜਾਂ ਪੈਦਲ ਵੀ ਨੇੜੇ ਹੀ ਆ ਗੁਰਦੁਆਰਾ ਸਾਹਿਬ ਠੀਕ ਹੈ ਬੇਟਾ ਧੰਨਵਾਦ ਠੀਕ ਹੈ ਬੇਟਾ ਧੰਨਵਾਦ ਜੀ